ਚੌਵੀ ਮਈ ਦੋ ਹਜ਼ਾਰ ਉੱਨੀ ਅਗਸਤ ਦੋ ਹਜ਼ਾਰ ਬਾਰਾਂ ਅਠਾਰਾਂ ਅਪ੍ਰੈਲ ਉੱਨੀ ਸੌ ਅਠਾਸੀ ਦਸ ਨਵੰਬਰ ਉੱਨੀ ਸੌ ਇਕਾਸੀ ਇੱਕ ਜਨਵਰੀ ਦੋ ਹਜ਼ਾਰ ਚੌਵੀ